ਅਤੇ ਇੱਥੇ ਸਾਡੇ ਪੰਜਾਬ ਵਿੱਚ ਕਈ ਪ੍ਰਕਾਰ ਦੀਆਂ ਸਕੋਲਰਸ਼ਿਪ ਦਾ ਵਿਦਿਆਰਥੀਆਂ ਨੂੰ ਮਿਲਦੀਆਂ ਹਨ ਕਈ ਸਕੀਮਾਂ ਹਨ ਵਿਦਿਆਰਥੀਆਂ ਲਈ ਸਕੋਲਰਸ਼ਿਪ ਦੀਆਂ ਮੈਂ ਆਪ ਇੱਕ ਸਕਿਉਲਟੀ ਦੀ ਜੋਬ ਕਰਦਾ ਹਾਂ ਯੂਨੀਵਰਸਿਟੀ ਵਿੱਚ ਉੱਥੇ ਮੈਂ ਆਪ ਦੇਖਿਆ ਐਡਮਿਨ ਵਿੱਚ ਮੇਰੀ ਡਿਊਟੀ ਹੈ ਉੱਥੇ ਕਈ ਸ ਸਾਰੇ ਕਈ ਤਰ੍ਹਾਂ ਦੀਆਂ ਵਿਦਿਆਰਥੀਆਂ ਨੂੰ ਸਕੋਲਰਸ਼ਿਪ ਦਿੱਤੀ ਜਾਂਦੀ ਹੈ ਐਸੀ ਕਾਸਟ ਲਈ ਸਕੋਲਰਸ਼ਿਪ ਬਿਲਕੁਲ ਫਰੀ ਹੈ ਕੋਈ ਫੀਸ ਵੀ ਨਹੀਂ ਦੇਣੀ ਪੈਂਦੀ ਉਹਨਾਂ ਨੂੰ ਅਤੇ ਜਿਨ੍ਹਾਂ ਦੇ ਨੰਬਰ ਚੰਗੇ ਆਏ ਹੁੰਦੇ ਹਨ ਉਹਨਾਂ ਨੂੰ ਵੀ ਅਲੱਗ ਤਰ੍ਹਾਂ ਦੀ ਸਕੋਲਰਸ਼ਿਪ ਦਿੱਤੀ ਜਾਂਦੀ ਹੈ ਅਤੇ ਜਿਨ੍ਹਾਂ ਦੇ ਮਾਪੇ ਨਹੀਂ ਹਨ ਬੱਚੇ ਹਨ ਗਰੀਬ ਪਰਿਵਾਰ ਦੇ ਹਨ ਉਹਨਾਂ ਨੂੰ ਵੀ ਅਲੱਗ ਤਰ੍ਹਾਂ ਦੀ ਸਕੋਲਰ ਸ਼ਿਪ ਦਿੱਤੀ ਜਾਂਦੀ ਹੈ ਸਿੱਖ ਪਰਿਵਾਰ ਲਈ ਵੀ ਅਲੱਗ ਸਕੋਲਰਸ਼ਿਪ ਹੈ ਜਿੰਨਾਂ ਦੇ ਨੰਬਰ ਪੂਰੇ ਹੋਣ ਉਹਨਾਂ ਨੂੰ ਵੀ ਸਕੋਲਰਸ਼ਿਪ ਦਿੱਤੀ ਜਾਂਦੀ ਹੈ ਸਰਕਾਰ ਸਾਰਾ ਖ਼ਰਚਾ ਇਹਨਾਂ ਦਾ ਆਪ ਚੁੱਕਦੀ ਹੈ ਅਤੇ ਫਰੀ ਪੜ੍ਹਾਈ ਹੁੰਦੀ ਹੈ ਇਸ ਲਈ ਇਹਨੂੰ ਕੋਈ ਬੱਚਾ ਵਿਦਿਆਰਥੀਆਂ ਕੋਲੋਂ ਕੋਈ ਪੈਸਾ ਨਹੀਂ ਲਿੱਤਾ ਜਾਂਦਾ